ਮੇਰੇ ਅਨੁਸਾਰ ਭੰਗੜਾ ਐਰੋਬਿਕ ਭਵਿੱਖ ਵਿੱਚ ਬਹੁਤ ਪ੍ਰਸਿੱਧ ਹੋਇਆ ਹੈ ਕਿਉਂਕਿ ਇਸ ਵਿੱਚ ਕਾਫੀ ਤਰ੍ਹਾਂ ਦੇ ਹਰਕਤਾਂ ਕੀਤੀਆਂ ਜਾਂਦੀਆਂ ਹੈ ਆਪਣੇ ਸਰੀਰ ਵੱਲੋਂ ਕਿਉਂਕਿ ਇਸ ਵਿੱਚ ਅਸੀਂ ਨੱਚਦੇ ਹਾਂ ਟੱਪਦੇ ਹਾਂ ਕਾਫੀ ਅਨੈ ਅਨਰਜੈਟਿਕ ਆਪਾਂ ਐਕਸਰਸਾਈਜ਼ ਵਗੈਰਾ ਕਰਦੇ ਹਾਂ ਇਸ ਕਰਕੇ ਇਹ ਐਰੋਬਿਕ ਭਵਿੱਖ ਵਿੱਚ ਬਹੁਤ ਪ੍ਰਸਿੱਧ ਹੋਇਆ